ਸਾਡੇ ਖੇਤਰ ਵਿੱਚ ਕਲਾ ਅਤੇ ਸ਼ਿਲਪਕਾਰੀ ਖੇਤਰ ਰਾਜ ਦੀ ਸੱਭਿਆਚਾਰਕ ਪਛਾਣ ਅਤੇ ਵਿਰਾਸਤ ਵਿੱਚ ਪਰੰਪਰਾਵਾਂ ਚਿੰਨ੍ਹ ਮੁੱਲ ਇਹ ਸਾਰੇ ਹੀ ਯੋਗਦਾਨ ਪਾਉਂਦੇ ਹਨ ਅਸੀਂ ਪੁਰਾਣੇ ਪੰਜਾਬ ਦੀਆਂ ਪੁਰਾਣੀਆਂ ਪਰੰਪਰਾਵਾਂ ਤੋਂ ਉਹਨਾਂ ਦੇ ਕਲਾਵਾਂ ਸ਼ਿਲਪਕਾਰਿਆਂ ਨਾਲ ਜਾਣੂ ਹੁੰਦੇ ਹਾਂ ਜਿਹਨਾਂ ਵਿੱਚ ਉਹਨਾਂ ਦੇ ਚਿੰਨ੍ਹ ਸਾਨੂੰ ਜਾਣਨ ਨੂੰ ਮਿਲਦੇ ਹਨ ਉਹਨਾਂ ਦਿਆਂ ਮੁੱਲਾਂ ਬਾਰੇ ਸਾਨੂੰ ਪਤਾ ਲੱਗਦਾ ਹੈ ਪਹਿਲਾਂ ਪੰਜਾਬੀ ਸੱਭਿਆਚਾਰ ਅਤੇ ਸ਼ ਕਲਾਵਾਂ ਵਿੱਚ ਪ੍ਰੇਮ ਭਾਵਨਾ ਦਇਆ ਭਾਵਨਾ ਸਾਹਨੋਬੁੱਤੀ ਭਾਵਨਾ ਕਰੁਣਾ ਭਾਵਨਾ ਆਦਿ ਸਭ ਮੁੱਲ ਸ਼ਾਮਿਲ ਹੁੰਦੇ ਸਨ ਸਨ ਪਰ ਅੱਜ ਦੇ ਸਮੇਂ ਵਿੱਚ ਇਹ ਮੁੱਲ ਹੌਲੀ ਹੌਲੀ ਘਟਦੇ ਜਾ ਰਹੇ ਹਨ ਲੋਕਾਂ ਵਿੱਚ ਈਰਖਾ ਪੈਦਾ ਹੋਣ ਲੱਗੀ ਹੈ ਗੁੱਸਾ ਪੈਦਾ ਹੋਣ ਲੱਗਾ ਤਣਾਅ ਆਦਿ ਪੈਦਾ ਹੋਣ ਲੱਗੇ ਹਨ ਜਿਸ ਨਾਲ ਸਾਡੇ ਪੰਜਾਬੀ ਕਲਾਵਾਂ ਸ਼ਿਲਪਕਾਰੀਆਂ ਆਦਿ ਵਿੱਚ ਕਟੌਤੀ ਹੁੰਦੀ ਜਾ ਰਹੀ ਹੈ ਸਾਨੂੰ ਇਹਨਾਂ ਨੂੰ ਸੰਭਾਲ ਕੇ ਰੱਖਣ ਦੀ ਜ਼ਰੂਰਤ ਹੈ